ਹਰ ਜ਼ਿਲ੍ਹਾ ਆਪਣੀ ਵਿਲੱਖਣਤਾ ਦੇ ਲਈ ਜਾਣਿਆ ਜਾਂਦਾ ਹੈ ਜਿਵੇਂ ਕਿ ਅੰਮ੍ਰਿਤਸਰ ਜ਼ਿਲ੍ਹਾ ਵੀ ਆਪਣੀ ਕਲਾ ਸ਼ਿਲਪਕਾਰੀ ਦੇ ਲਈ ਜਾਣਿਆ ਜਾਂਦਾ ਹੈ ਜਿਵੇਂ ਕਿ ਇੱਥੇ ਫੁਲਕਾਰੀ ਬਹੁਤ ਮਸ਼ਹੂਰ ਹੈ ਫੁਲਕਾਰੀ ਕੱਢਣ ਵਾਲੇ ਲੋਕ ਪੀੜ੍ਹੀ ਦਰ ਪੀੜ੍ਹੀ ਇਹ ਕੰਮ ਕਰਦੇ ਆ ਰਹੇ ਹਨ ਅਤੇ ਅੱਜ ਅੰਮ੍ਰਿਤਸਰ ਦੀ ਫੁਲਕਾਰੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਮਸ਼ਹੂਰ ਹੈ ਲੋਕ ਇੱਥੋਂ ਫੁਲਕਾਰੀਆਂ ਖਰੀਦ ਕੇ ਲੈ ਕੇ ਜਾਂਦੇ ਹਨ ਅਸ ਦਰਅਸਲ ਫੁਲਕਾਰੀ ਦਾ ਇਤਿਹਾਸ ਵਿੱਚ ਵੀ ਆਪਣੇ ਆਪ ਵਿੱਚ ਇੱਕ ਵਿਲੱਖਣ ਹੈ ਜਦੋਂ ਪੰਜਾਬ ਦੇ ਘਰਾਂ ਵਿੱਚ ਧੀਆਂ ਦਾ ਜਨਮ ਹੁੰਦਾ ਹੈ ਤਾਂ ਉਸ ਧੀ ਦੀ ਮਾਂ ਜਾਂ ਦਾਦੀ ਜਾਂ ਨਾਨੀ ਜਿਹੜੀ ਹੈ ਘਰ ਵਿੱਚ ਉਹ ਦੇ ਲਈ ਫੁਲਕਾਰੀ ਬਣਾਉਣੀ ਸ਼ੁਰੂ ਕਰ ਦਿੰਦੀ ਹੈ ਫੁਲਕਾਰੀ ਜਿਹੜੀ ਹੈ ਇਹ ਇੱਕ ਜੁਮੈਟਿਕਲ ਡਿਜ਼ਾਈਨ ਜਾਂ ਫੁੱਲਾਂ ਦੇ ਡਿਜ਼ਾਈਨ ਦੇ ਨਾਲ ਤਿਆਰ ਕੀਤੀ ਜਾਂਦੀ ਹੈ ਸੂਈ ਧਾਗੇ ਦੇ ਨਾਲ ਇਸ ਨੂੰ ਕੱਢਿਆ ਜਾਂਦਾ ਹੈ ਆਂਢ ਗੁਆਂਢ ਦੀਆਂ ਜਿਹੜੀਆਂ ਔਰਤਾਂ ਹਨ ਉਹ ਇਕੱਠੀਆਂ ਬੈਠਦੀਆਂ ਹਨ ਅਤੇ ਇਸ ਨੂੰ ਬਣਾਉਂਦੀਆਂ ਹਨ ਪੁਰਾਣਾ ਇਤਿਹਾਸ ਇਹਦਾ ਇਹ ਹੈ ਅਤੇ ਜਦੋਂ ਧੀ ਦਾ ਵਿਆਹ ਹੁੰਦਾ ਸੀ ਉਦੋਂ ਇਸ ਨੂੰ ਉਹ ਦਿੱਤਾ ਜਾਂਦਾ ਸੀ ਗਿਫ਼ਟ ਦੇ ਤੌਰ 'ਤੇ ਸੋ ਅੱਜ ਕੁਝ ਲੋਕ ਨੇ ਜੋ ਇਹਨਾਂ ਫੁਲਕਾਰੀਆਂ ਨੂੰ ਕੱਢਦੇ ਹਨ ਇਹ ਇੱਕ ਪ੍ਰੋਫੈਸ਼ਨ ਹੋ ਚੁੱਕਾ ਹੈ ਅਤੇ ਅੰਮ੍ਰਿਤਸਰ ਦੀਆਂ ਜਿਹੜੀਆਂ ਫੁਲਕਾਰੀਆਂ ਹਨ ਇਹ ਦੂਰ ਦੁਰਾਡੇ ਤੱਕ ਜਾਂਦੀਆਂ ਹਨ ਅਤੇ ਵਿਕਦੀਆਂ ਹਨ ਅਤੇ ਇਹ ਇਸ ਨੂੰ ਉਹ ਸੰਭਾਲੇ ਹੋਏ ਹਨ ਧੰਨਵਾਦ